ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ ਮੈਂ ਤੁਹਾਡੀ ਕੰਪਨੀ 'ਚੋਂ ਇੱਕ ਪ੍ਰੋਡਕਟ ਖ੍ਰੀਦਿਆ ਸੀ ਮੈਨੂੰ ਉਹ ਪ੍ਰੋਡਕਟ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਅਤੇ ਮੈਂ ਖੁਦ ਜਦੋਂ ਉਹ ਪ੍ਰੋਡਕਟ ਵਰਤਿਆ ਵਰਤਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਅਤੇ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਨੂੰ ਤੁਹਾਡੇ ਉਸ ਪ੍ਰੋਡਕਟ ਬਾਰੇ ਦੱਸਿਆ ਜਿਹਦੇ ਨਾਲ਼ ਸੁਣ ਕੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲੀ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਇਹ ਹੀ ਸਲਾਹ ਦਿੱਤੀ ਕਿ ਤੁਹਾਡੀ ਕੰਪਨੀ 'ਚੋਂ ਹੀ ਉਹ ਪ੍ਰੋਡਕਟ ਲਿਆ ਜਾਵੇ ਅਤੇ ਇਹ ਵੀ ਦੱਸਿਆ ਵਧੀਆ ਦੇ ਨਾਲ਼ ਨਾਲ਼ ਉਹ ਪ੍ਰੋਡਕਟ ਬਹੁਤ ਸਤਾ ਸਸਤਾ ਵੀ ਹੈ ਅਤੇ ਜਦੋਂ ਆਪਾਂ ਉਹ ਪ੍ਰੋਡਕਟ ਖਰੀਦਦੇ ਹੈਂ ਅਤੇ ਵੇਚਣ ਵਾਲ਼ੇ ਵੀ ਬਹੁਤ ਪਿਆਰ ਨਾਲ ਅਤੇ ਬਹੁਤ ਵਧੀਆ ਢੰਗ ਨਾਲ਼ ਸਾਡੇ ਨਾਲ਼ ਪੇਸ਼ ਆਉਂਦੇ ਹੈਂ ਅਤੇ ਮੈਂ ਬਹੁਤ ਖੁਸ਼ ਹਾਂ ਤੁਹਾਡਾ ਇਹ ਪ੍ਰੋਡਕਟ ਵਰਤ ਕੇ